ਪਹਿਲਾਂ ਤੇ ਹੁਣ ਦੀਆਂ ਯਾਤਰੀ ਬੱਸਾਂ ਵਿੱਚ ਜੀ ਬਹੁਤ ਜ਼ਿਆਦਾ ਸੁਧਾਰ ਆਇਆ ਹੈ ਪਹਿਲਾਂ ਜਿਵੇਂ ਕੀ ਜਿਹੜੀਆਂ ਬੱਸਾਂ ਹੁੰਦੀਆਂ ਸਨ ਉਹਨਾਂ ਵਿੱਚ ਕੋਈ ਵੀ ਏ ਸੀ ਵਗੈਰਾ ਨਹੀਂ ਹੁੰਦਾ ਸੀਗਾ ਸੀਟਾਂ ਦੀ ਥਾਂ ਤੇ ਵੀ ਮਤਲਬ ਫੱਟੇ ਵਰਗੀਆਂ ਸੀਟਾਂ ਹੁੰਦੀਆਂ ਸੀਗੀਆਂ ਤੇ ਹੁਣ ਦੀਆਂ ਜਿਹੜੀਆਂ ਬੱਸਾਂ ਨਵੀਆਂ ਆਈਆਂ ਹਨ ਉਹ ਪੂਰੀ ਤਰ੍ਹਾਂ ਫੁੱਲੀ ਏ ਸੀ ਹੈ ਤੇ ਉਹਦੇ ਵਿੱਚ ਉਹ ਹੁਣ ਇਲੈਕਟ੍ਰਿਕ ਬੱਸਾਂ ਵੀ ਜਿਵੇਂ ਕੀ ਕਈ ਕੰਪਨੀਆਂ ਇਲੈਕਟ੍ਰਿਕ ਬੱਸਾਂ ਲੋਂਚ ਕਰਤੀਆਂ ਐ ਜਿਵੇਂ ਕੀ ਚੰਡੀਗੜ੍ਹ ਵਿੱਚ ਇਸ ਟਾਈਮ ਇਲੈਕਟ੍ਰਿਕ ਬੱਸਾਂ ਚੱਲ ਰਹੀਆਂ ਹਨ ਜਿਹਦੇ ਨਾਲ ਆਪਣਾ ਵਾਤਾਵਰਨ ਜ਼ਿਆਦਾ ਖਰਾਬ ਨਹੀਂ ਹੁੰਦਾ ਤੇ ਇਹ ਜਿਹੜੀਆਂ ਹੁਣ ਨਵੀਆਂ ਬੱਸਾਂ ਹਨ ਐਦੇ ਵਿੱਚ ਆਪਾਂ ਨੂੰ ਸਟੋਰੇਜ ਵੀ ਜ਼ਿਆਦਾ ਮਿਲਦੀ ਐ ਤੇ ਇਹਦੇ ਵਿੱਚ ਬਹੁਤ ਜ਼ਿਆਦਾ ਜਿਹੜੀਆਂ ਸੀਟਾਂ ਹੈਗੀਆਂ ਜੀ ਉਹ ਬਹੁਤ ਜ਼ਿਆਦਾ ਕੰਫਰਟੇਬਲ ਲਗਾਈਆਂ ਹੋਈਆਂ ਏ ਤੇ ਇਹਨਾਂ ਵਿੱਚ ਜਿਵੇਂ ਕੀ ਆਪਣੇ ਕੋਲ ਲਗੇਜ ਵਗੈਰਾ ਹੁੰਦਾ ਸਮਾਨ ਹੁੰਦਾ ਉਹਦੇ ਵਾਸਤੇ ਸੈਪਰੇਟ ਏਰੀਆ ਬਣਾਇਆ ਹੁੰਦਾ ਏ ਤੇ ਇਹਦੇ ਵਿੱਚ ਜਿਹੜੀਆਂ ਸੀਟਾਂ ਹੁੰਦੀਆਂ ਹਨ ਬਵੰ ਪੰਜਾਹ ਤੋਂ ਸੱਠ ਦੇ ਵਿੱਚ ਸੀਟਾਂ ਆਉਂਦੀਆਂ ਹਨ ਜੀ ਬੱਸ ਚ ਤੇ ਜੇ ਆਪਾਂ ਨੇ ਕਿਤੇ ਲੰਬੇ ਸਫਰ ਤੇ ਜਾਣਾ ਹੋਵੇ ਤਾਂ ਆਹ ਜਿਹੜੀ ਬੱਸ ਹੈਗੀ ਆ ਇਹ ਬਹੁਤ ਜ਼ਿਆਦਾ ਆਰਾਮਦਾਇਕ ਹੁੰਦੀ ਐ ਜਿਹੜੀਆਂ ਪੁਰਾਣੀਆਂ ਬੱਸਾਂ ਸੀਗੀਆਂ ਉਹ ਮਤਲਬ ਉਹ ਉਹਨਾਂ ਦੇ ਜਿਹੜੇ ਪਾ ਉਹਨਾਂ ਦੀਆਂ ਸੀਟਾਂ ਸੀਗੀਆਂ ਜੀ ਉਹ ਜ਼ਿਆਦਾ ਕੰਫਰਟੇਬਲ ਨੀ ਹੁੰਦੀਆਂ ਸੀਗੀਆਂ ਹੁਣ ਆਲ਼ੀਆਂ ਬੱਸਾਂ ਦੀਆਂ ਸੀਟਾਂ ਉਹਨਾਂ ਨੂੰ ਤੁਸੀਂ ਪਿੱਛੇ ਨੂੰ ਕਰਕੇ ਮਤਲਬ ਪੂਰਾ ਕੰਫਰਟੇਬਲ ਹੋ ਕੇ ਉਹਦੇ ਤੇ ਬੈਠ ਸਕਦੇ ਐ ਜੀ ਤੇ ਹੋਰ ਵੀ ਇਹਨਾਂ ਵਿੱਚ ਬਹੁਤ ਤਰ੍ਹਾਂ ਦੇ ਜਿਹੜੇ ਫੀਚਰ ਹੁੰਦੇ ਐ ਉਹ ਆਏ ਨੇ ਜੀ ਜਿਵੇਂ ਕੀ ਤੁਸੀਂ ਹੁਣ ਫ਼ੋਨ ਵੀ ਚਾਰਜ ਕਰ ਸਕਦੇ ਓ ਜਾਂ ਕੋਈ ਹੋਰ ਚੀਜ਼ ਚਾਰਜ ਕਰਨੀ ਹੁੰਦੀ ਆ ਉਹ ਤੁਹਾਡੇ ਸੀ ਸੀਟ ਦੇ ਕੋਲ ਇੱਕ ਸੋਕਿਟ ਲੱਗਿਆ ਵਾ ਹੁੰਦਾ ਏ ਜਿਹਦੇ ਵਿੱਚ ਤੁਸੀਂ ਡਾਟਾਕੇਬਲ ਲਾ ਕੇ ਆਪਣਾ ਫ਼ੋਨ ਜਾਂ ਕੋਈ ਹੋਰ ਚੀਜ਼ ਆ ਉਹਨੂੰ ਤੁਸੀਂ ਚਾਰਜ ਕਰ ਸਕਦੇ ਓ